ਮੈਂ ਆਪਣੀ ਕੁਸ਼ਲਤਾ ਰਚਨਾ ਨੂੰ ਬਣਾਈ ਰੱਖਣ ਲਈ ਡਰਾਇੰਗ ਸਮਗਰੀ ਵਿੱਚ ਪੈੱਨ ਅਡ ਅਲੱਗ ਅਲੱਗ ਤਰ੍ਹਾਂ ਦੇ ਪੈਨ ਅਲੱਗ ਅਲੱਗ ਤਰ੍ਹਾਂ ਦੇ ਪੇਪਰ ਅਲੱਗ ਅਲੱਗ ਤਰ੍ਹਾਂ ਦੇ ਕਲਰ ਕਲਰ ਆਦਿ ਦੀ ਵਰਤੋਂ ਕਰਦੀ ਹਾਂ ਕਈ ਵਾਰ ਮੈਨੂੰ ਡਰਾਇੰਗ ਦੀ ਸਮੱਗਰੀ ਆਪਣੇ ਇਲਾਕੇ ਵਿੱਚ ਨਹੀਂ ਮਿਲਦੀ ਤਾਂ ਮੈਂ ਆਨਲਾਈਨ ਸ਼ੋਪਿੰਗ ਤੋਂ ਮੰਗਵਾਉਂਦੀ ਹਾਂ ਕਈ ਵਾਰ ਕਈ ਦੂਸਰੇ ਇਲਾਕੇ ਵਿੱਚ ਜਾ ਕੇ ਵੀ ਇਸ ਬਾਰੇ ਪਤਾ ਕਰਦੀ ਹਾਂ ਕਿ ਇਹ ਸਮੱਗਰੀ ਮੈਨੂੰ ਮਿਲ ਸਕਦੀ ਹੈ ਕਿ ਨਹੀਂ ਡਰਾਇੰਗ ਬਣਾਉਣ ਲਈ ਅਲੱਗ ਅਲੱਗ ਇਲਾ ਇਲਾਕੇ ਜਾ ਕੇ ਦੇਖਦੀ ਹਾਂ ਕੌਣ ਸਾ ਕਿਹੜਾ ਡਰਾਇੰਗ ਲਈ ਮੇਰੇ ਲਈ ਬੈਸਟ ਡਿਜ਼ਾਇਨ ਹੈ